ਮੈਨੂੰ ਪੇਂਟਿੰਗ ਕਰਨਾ ਬਹੁਤ ਵਧੀਆ ਲੱਗਦਾ ਹੈ ਮੈਂ ਆਪਣੇ ਸਕੂਲ ਟਾਈਮ ਤੋਂ ਹੀ ਪੇਂਟਿੰਗ ਕਰਦੀ ਹਾਂ ਮੈਂ ਅ ਸਾਡੇ ਸਕੂਲ ਵਿੱਚ ਪੇਂਟਿੰਗ ਦੇ ਮੁਕਾਬਲੇ ਹੁੰਦੇ ਸਨ ਮੈਂ ਉਹਨਾਂ ਵਿੱਚ ਫਸਟ ਆਉਂਦੀ ਸੀ ਮੈਂ ਮੈਂ ਆਪਣੇ ਸੂਟ ਚਾਦਰਾਂ ਕੁਸ਼ਨ ਕਵਰ ਆਦਿ ਪੇਂਟ ਕੀਤੇ ਹਨ ਅਤੇ ਅਤੇ ਇੱਕ ਵਾਰ ਮੈਂ ਆਪਣਾ ਸੂਟ ਪੇਂਟ ਕੀਤਾ ਸੀ ਉਹ ਸੂਟ ਬਹੁਤ ਵਧੀਆ ਬਣਿਆ ਮੈਂ ਉਸ ਉਹ ਪਲੇਨ ਸੂਟ ਬਾਜ਼ਾਰ ਵਿੱਚੋਂ ਲੈ ਕੇ ਆਈ ਸੀ ਅਤੇ ਉਸ ਉੱਤੇ ਪੇਂਟ ਕੀਤਾ ਮੈਂ ਫੈਬਰਿਕ ਫੈਬਰਿਕ ਕਲਰਜ਼ ਨਾਲ ਉਸ ਫੈਬਰਿਕ ਕਲਰਜ਼ ਨਾਲ ਉਸ 'ਤੇ ਪੇਂਟ ਕੀਤਾ ਉਸ ਸੂਟ ਉੱਤੇ ਉਸ ਸੂਟ ਉੱਤੇ ਮੈਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਜਿਹੜੇ ਕਲਰ ਨੇ ਉਹ ਮੈਂ ਯੂਜ਼ ਕੀਤੇ ਜਿਵੇਂ ਗਰੀਨ ਕਲਰ ਯੂਜ਼ ਕੀਤਾ ਸੀ ਵਾਈਟ ਕਲਰ ਯੂਜ਼ ਕੀਤਾ ਸੀ ਬਰਾਉਨ ਕਲਰ ਯੂਜ਼ ਕੀਤਾ ਸੀ ਅਤੇ ਬਲੈਕ ਕਲਰ ਨਾਲ ਮੈਂ ਉਸ ਸਾਰੇ ਜਿਹੜਾ ਮੈਂ ਪੈਟਰਨ ਬਣਾਇਆ ਸੀਗਾ ਹੈ ਨਾ ਉਹਦੀ ਆਊਟਲਾਈਨਿੰਗ ਮੈਂ ਉਸ ਬਲੈਕ ਕਲਰ ਨਾਲ ਕੀਤੀ ਸੀ ਜਿਸ ਦੇ ਕਰਕੇ ਉਹ ਹੋਰ ਵੀ ਸੋਹਣਾ ਲੱਗਣ ਲੱਗਿਆ ਮੈਂ ਸੂਟ ਦੇ ਘੇਰੇ ਉੱਤੇ ਚਿੜੀਆਂ ਅਤੇ ਤੋਤਿਆਂ ਦਾ ਵਿਊ ਬਣਾਇਆ ਸੀ ਵਿਊ ਬਣਾਇਆ ਸੀ ਅਤੇ ਮੈਂ ਸੂਟ ਦੀਆਂ ਬਾਹਵਾਂ ਅਤੇ ਨਿੱਚੇ ਮੂਰੀਆਂ 'ਤੇ ਵੀ ਡਿਜ਼ਾਇਨ ਕੀਤਾ ਸੀ ਅਤੇ ਚੁੰਨੀ ਦੇ ਸਾ ਚੁੰਨੀ ਦੇ ਚਾਰੇ ਕਿਨਾਰਿਆਂ ਉੱਤੇ ਮੈਂ ਡਿਜ਼ਾਇਨ ਕੀਤਾ ਸੀ ਉਹ ਡਿਜ਼ਾਇਨ ਸਭ ਨੂੰ ਬਹੁਤ ਪਸੰਦ ਆਇਆ ਅਤੇ ਉਸਨੂੰ ਬਣਾਉਣ ਲਈ ਮੇਰਾ ਤਿੰਨ ਤੋਂ ਚਾਰ ਦਿਨ ਦਾ ਸਮਾਂ ਲੱਗਿਆ ਅਤੇ ਉਹ ਬਹੁਤ ਵਧੀਆ ਡਿਜ਼ਾਇਨ ਬਣਿਆ ਉਹ ਮੇਰਾ ਸੂਟ ਬਹੁਤ ਵਧੀਆ ਬਣਿਆ ਅਤੇ ਸਭ ਨੂੰ ਪਸੰਦ ਆਇਆ ਅਤੇ ਮੈਂ ਹੋ ਉਹ ਤੋਂ ਬਾਅਦ ਹੋਰ ਦੋ ਸੂਟ ਪੇਂਟ ਕੀਤੇ